ਹੈਲੋ ਹੈਲੋ ਜੋਤੀ ਰਾਣੀ ਪ੍ਰੋਪਰਟੀ ਡੀਲਰ ਸਤਿ ਸ਼੍ਰੀ ਅਕਾਲ ਜੀ ਜੀ ਮੈਨੂੰ ਤੁਹਾਡਾ ਨੰਬਰ ਮੇਰੇ ਬ੍ਰਦਰ ਤੋਂ ਮਿਲਿਆ ਸੀਗਾ ਹਾਂਜੀ ਮੈਂ ਪ੍ਰੋਪਰਟੀ ਬਾਰੇ ਗੱਲ ਕਰਨੀ ਸੀ ਮਾਨਸਾ ਜ਼ਿਲ੍ਹੇ ਵਿੱਚ ਕਿ ਪ੍ਰੋਪਰਟੀ ਕਿਵੇਂ ਦੀ ਉੱਥੇ ਕਿਵੇਂ ਦਾ ਰਹਿਣ ਸਹਿਣ ਹੈਗਾ ਅਤੇ ਕਿਵੇਂ ਦਾ ਸਾਰਾ ਕੁਛ ਹੈਗਾ ਹਾਂਜੀ ਹਾਂਜੀ ਹਾਂਜੀ ਅਸੀਂ ਮਤਲਬ ਚਾਰ ਪਰਿਵਾਰ ਦੇ ਫੈਮਿਲੀ ਦੇ ਚਾਰ ਮੈਂਬਰ ਹਾਂ ਉਸ ਟਾਈਪ ਦਾ ਸਾਨੂੰ ਘਰ ਚਾਹੀਦਾ ਜਿੱਥੇ ਜ਼ਿਆਦਾ ਸ਼ੋਰ ਸ਼ਰਾਬਾ ਨਾ ਹੋਵੇ ਸੜਕ ਨੇੜੇ ਹੋਵੇ ਆਉਣ ਜਾਣ ਦੀ ਵਧੀ ਵਧੀਆ ਸੁਵਿਧਾ ਹੋਵੇ

ਹਾਂਜੀ ਕਿਵੇਂ ਡਬਲ ਪੋਰਸ਼ਨ ਹੋਣਾ ਚਾਹੀਦਾ

ਹਾਂਜੀ ਠੀਕ ਹੈ ਜੀ ਠੀਕ ਹੈ ਅਤੇ ਹਾਊਸ ਦੇ ਵਿੱਚ ਪਾਣੀ ਦੀ ਪ੍ਰੋਪਰ ਸੁਵਿਧਾ ਹੋਊਗੀ

ਠੀਕ ਆ ਜੀ ਠੀਕ ਆ ਵੈਸੇ ਮੈਨੂੰ ਤੁਹਾਡਾ ਸੁਝਾਅ ਬਹੁਤ ਵਧੀਆ ਲੱਗਿਆ ਹਾਂਜੀ ਹਾਂਜੀ ਠੀਕ ਆ ਬਹੁਤ ਵਧੀਆ ਦੱਸਿਆ ਤੁਸੀਂ ਅਸੀਂ ਜ਼ਰੂਰ ਸੋਚਾਂਗੇ ਪ੍ਰੋਪਰਟੀ ਲੈਣ ਬਾਰੇ ਠੀਕ ਹੈ ਥੈਂਕ ਯੂ